ਮੈਂ ਅਕਸਰ ਯਾਤਰਾਵਾਂ ਕਰਦੀ ਰਹਿੰਦੀ ਹਾਂ ਕਿਉਂਕਿ ਯਾਤਰਾਵਾਂ ਦੇ ਨਾਲ ਮੇਰੇ ਗਿਆਨ ਵਿੱਚ ਵਾਧਾ ਹੁੰਦਾ ਹੈ ਜਦੋਂ ਵੀ ਮੈਂ ਕਿਸੇ ਨਵੇਂ ਸਥਾਨ 'ਤੇ ਜਾਂਦੀ ਹਾਂ ਮੈਂ ਉਥੋਂ ਦੇ ਸੱਭਿਆਚਾਰ ਉਹਨਾਂ ਦੇ ਰਹਿਣ ਸਹਿਣ ਅਤੇ ਉਹਨਾਂ ਦੇ ਪਕਵਾਨਾਂ ਬਾਰੇ ਜਾਣ ਜਾਣਕਾਰੀ ਪ੍ਰਾਪਤ ਕਰਦੀ ਹਾਂ ਇਸ ਨਾਲ ਮੇਰੇ ਮਨ ਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ਅਤੇ ਮੈਨੂੰ ਬਹੁਤ ਸਾਰੀ ਨੌਲੇਜ ਮਿਲਦੀ ਹੈ